ਜੀ ਹਾਂ ਮੈਂ ਇਹ ਸੋਚਦੀ ਹਾਂ ਕਿ ਪ੍ਰਸ਼ਾਸਨ ਵੱਲੋਂ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਹਨ ਇਹ ਉਪਰਾਲੇ ਪੰਜਾਬੀ ਭਾਸ਼ਾ ਨੂੰ ਉੱਪਰ ਚੁੱਕਣ ਲਈ ਕਰ ਰਹੇ ਹਨ ਜਿਸ ਵਿੱਚ ਪੰਜਾਬੀ ਦੀ ਭਾਸ਼ਾ ਸਕੂਲਾਂ ਵਿੱਚ ਦਸਵੀਂ ਤੱਕ ਲਾਜ਼ਮੀ ਕੀਤੀ ਗਈ ਹੈ ਅਤੇ ਮੀਡੀਆ ਵਿੱਚ ਪੰਜਾਬੀ ਅਖਬਾਰ ਅਤੇ ਪੰਜਾਬੀ ਚੈਨਲ ਵੀ ਦਿਖਾਏ ਜਾਂਦੇ ਹਨ ਇਹ ਹੀ ਬਸ ਨਹੀਂ ਹੋਰਡਿੰਗ ਵੀ ਪੰਜਾਬੀ ਵਿੱਚ ਬੋਰਡ ਲਿਖਣੇ ਲਾਜ਼ਮੀ ਕਰ ਦਿੱਤੇ ਗਏ ਹਨ